ਮੈਂ ਨਾ ਐਮਾਜੋਨ ਤੋਂ ਬੂਟ ਮੰਗਵਾਏ ਸੀਗੇ ਸ਼ੂਜ ਜਿਹੜੀ ਕਿ ਯਾਰ ਬਹੁਤ ਵਧੀਆ ਡਿਲੀਵਰੀ ਆ ਉਹਨਾਂ ਦੀ ਕਈ ਵਾਰ ਮੰਗਵਾ ਲਏ ਮੈਂ ਬੂਟ ਉਹਨਾਂ ਤੋਂ ਅਤੇ ਸਹੀ ਟਾਈਮ 'ਤੇ ਆ ਜਾਂਦੇ ਨੇ ਅਤੇ ਬੂਟ ਇੰਨੇ ਵਧੀਆ ਨੇ ਯਾਰ ਲੈਦਰ ਦੇ ਵੀ ਮੰਗਵਾਏ ਸੀ ਅਤੇ ਸਪੋਰਟਸ ਵੀ ਮੰਗਵਾਏ ਸੀਗੇ ਸਪੋਰਟ ਸ਼ੂਜ਼ ਜਿਹੜੇ ਨੇ ਉਹ ਤਾਂ ਪਾ ਕੇ ਐਂ ਲੱਗਦਾ ਵੀ ਪੈਰਾਂ ਦੇ ਵਿੱਚ ਕੁਛ ਪਾ ਹੀ ਨਹੀਂ ਹੋਇਆ ਬਾਹਲੇ ਹੌਲੇ ਹੈ ਅਤੇ ਇੰਨੇ ਰਿਲੈਕਸ ਰੱਖਦੇ ਨੇ ਸਰੀਰ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੁਛ ਪਾਇਆ ਕਿ ਨਹੀਂ ਅਤੇ ਤੁਰਨ ਦੇ ਵਿੱਚ ਕੋਈ ਦਿੱਕਤ ਨਹੀਂ ਪਹਿਲਾਂ ਮੇਰੀ ਬੈਕ ਦਰਦ ਹੁੰਦਾ ਰਹਿੰਦਾ ਸੀ ਇੱਥੇ ਅਤੇ ਉਹ ਵੀ ਯਾਰ ਬਿਲਕੁਲ ਢੂਹੀ ਦੇ ਵਿੱਚੋਂ ਦਰਦ ਹੋਣੋ ਹੱਟ ਗਿਆ ਤੁਰਨ ਦੇ ਵਿੱਚ ਕੋਈ ਦਿੱਕਤ ਨਹੀਂ ਕੋਈ ਗਰਮੀ ਨਹੀਂ ਆਉਂਦੀ ਮੁੜਕਾਂ ਨਹੀਂ ਆਉਂਦਾ ਬੂਟਾਂ ਦੇ ਵਿੱਚ ਐਂ ਲੱਗਦਾ ਵੀ ਭੱਜੀ ਜਾਈਏ ਭੱਜੀ ਜਾਈਏ ਬੂਟ ਪਾ ਕੇ ਅਤੇ ਲੈਦਰ ਦੇ ਵੀ ਬਹੁਤ ਵਧੀਆ ਨੇ ਇਹਨਾਂ ਦੇ ਸ਼ੂਜ਼ ਪੂਰੀ ਸ਼ੈਨਿੰਗ ਦਿੰਦੇ ਨੇ

ਕੋਈ ਪਸੀਨਾ ਨਹੀਂ ਆਉਂਦਾ ਉਹਨਾਂ ਦੇ ਵਿੱਚ ਲੈਦਰ ਦੇ ਬੂਟ ਪਾ ਕੇ ਜਿਹੜੇ ਮੰਗਵਾਏ ਸੀ ਐਮਾਜੋਨ ਤੋਂ ਅਤੇ ਇਹਨਾਂ ਦੀ ਸਰਵਿਸ ਬਾਹਲੀ ਵਧੀਆ ਯਾਰ ਕੋਈ ਉਲਾਂਭਾ ਨਹੀਂ ਕੋਈ ਐਂ ਨਹੀਂ ਹੋਇਆ ਵੀ ਕਦੇ ਡਿਲੇਅ ਹੋ ਗਏ ਜਾਂ ਰੁਕ ਗਏ ਰਸਤੇ ਦੇ ਵਿੱਚ ਵੀ ਆਪਣੇ ਬੂਟ ਜੀ ਜਾਂ ਨਕਲੀ ਚੀਜ਼ ਆ ਗਈ ਕੋਈ ਵੀ ਆਪਾਂ ਰੇਡਟੇਪ ਦੇ ਮੰਗਵਾਏ ਸੀ ਕੋਈ ਨਕਲੀ ਆ ਗਏ ਇਸ ਤਰ੍ਹਾਂ ਦੀ ਕੋਈ ਨਹੀਂ ਦਿੱਕਤ ਹੀ ਨਹੀਂ ਹੈਗੀ ਕੋਈ ਰੀਜਨਲ ਚੀਜ਼ ਪਹੁੰਚਦੀ ਆ ਘਰ ਬਿਲਕੁਲ ਬਹੁਤ ਵਧੀਆ ਸਰਵਿਸ ਆ ਯਾਰ ਇਹਨਾਂ ਦੀ ਐਮਾਜੋਨ ਵਾਲਿਆਂ ਦੀ